ਸਤਿ ਸ਼੍ਰੀ ਅਕਾਲ ਜੀ ਹਾਂਜੀ ਵਧੀਆ ਸਰ ਵਧੀਆ ਤੁਸੀਂ ਸੁਣਾਓ ਜੀ ਠੀਕ ਹੈ ਜੀ

ਹਾਂਜੀ ਹਾਂਜ ਇਹ ਭਾਅ ਜੀ ਵੀ ਟ੍ਰੈਡ ਤਾਂ ਜਿੱਦਾਂ ਦੇਖਿਆ ਜਾਵੇ ਇਹਦਾ ਤਾਂ ਪਹਿਲਾਂ ਆਪਾਂ ਪਹਿਲਾਂ ਸਾਨੂੰ ਇਹਦਾ ਪਿਛੋਕੜ ਜਾਣਨਾ ਪੈਣਾ ਹੈਗਾ ਹੈ ਜੀ ਕੋਈ ਵੀ ਆਪਾਂ ਟ੍ਰੈਂਡ ਚੱਲਦਾ ਕਿਉਂਕਿ ਉਹਦਾ ਤਾਂ ਪਹਿਲਾਂ ਤਾਂ ਭਾਅ ਜੀ ਸਾਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਵੀ ਟ੍ਰੈਂਡ ਚੱਲਿਆ ਕਿਉਂ ਹੈ

ਹਾਂਜੀ ਹਾਂਜੀ ਇਹ ਨਾ ਭਾਅ ਜੀ ਜਿੱਦਾਂ ਹੁਣ ਮੰਨ ਲਓ ਜਿੱਦਾਂ ਹੁਣ ਸਾਡਾ ਇੱਥੇ ਅੰਗਰੇਜ਼ ਤੁਹਾਨੂੰ ਪਤਾ ਸੀਗਾ ਸਾਡਾ ਅੰਗਰੇਜ਼ਾਂ ਨੇ ਸ਼ਾਹ ਰਾਜ ਕੀਤਾ ਸਾਡੇ 'ਤੇ ਉਹ ਨਾ ਇੱਥੇ ਦੇ ਨਾ ਕੁਛ ਕੁ ਬੰਦੇ ਸਾਡੇ ਜਿੱਦਾਂ ਹੈਗੇ ਤੇ ਕੁਛ ਕੁ ਜਿਹੜੇ ਉਹਨਾਂ ਨੂੰ ਚੰਗੇ ਲੱਗੇ ਉਹ ਆਪਣੇ ਨਾਲ ਲੈ ਗਏ ਬਾਹਰ ਉਹਦੇ ਵਾਸਤੇ ਮਤਲਬ ਆਪਣੀ ਸੈਨਾ ਸੂਨਾ 'ਚ ਭਰਤੀ ਵਾਸਤੇ ਹੋਰ ਕੰਮ ਕਾਰ ਵਾਸਤੇ ਆਪਣੇ ਨਾਲ ਉਹ ਉਹਨਾਂ ਨੂੰ ਨਾਲ ਲੈ ਗਏ ਉਹ ਤੋਂ ਬਾਅਦ ਜਦੋਂ ਉਹ ਮਤਲਬ ਇੱਥੇ ਆਏ ਹੈਗੇ ਹੈ ਇੱਥੇ ਅ ਦੇਸ਼ ਦੇ ਅਜ਼ਾਦ ਹੋਣ ਤੋਂ ਅੱਠ ਦਸ ਸਾਲ ਬਾਅਦ ਇੱਥੇ ਆਏ ਹੈਗੇ ਹੈ ਫਿਰ ਉਹਨਾਂ ਨੇ ਉੱਥੇ ਆ ਕੇ ਦੇਖਿਆ ਜਿਹੜੇ ਇੱਥੇ ਦੇ ਲੋਕ ਸੀਗੇ ਰਹਿੰਦੇ ਕਿਉਂਕਿ ਇੱਥੇ ਦੀ ਜਿਹੜੀ ਕਰੰਸੀ ਸੀ ਭਾਅ ਜੀ ਇੱਕ ਤਾਂ ਵੈਲਯੂ ਵੀ ਗਿਰ ਗਈ ਠੀਕ ਨਹੀਂ ਹੈਗਾ ਭਾਅ ਜੀ ਇੱਕ ਤਾਂ ਕਰੰਸੀ ਦੀ ਵੈਲਯੂ ਗਿਰ ਗਈ ਨੰਬਰ ਦੋ 'ਤੇ ਜਿਹੜੇ ਹਾਂਜੀ ਹਾਂਜੀ ਨੰਬਰ ਦੋ 'ਤੇ ਜਿਹੜੇ ਉੱਥੇ ਦੇ ਸੁੱਖ ਸੁਵਿਧਾਵਾਂ ਉਹਨਾਂ ਦਾ ਨੌਲੇਜ ਉਹਨਾਂ ਦਾ ਐਕਸਪੀਰੀਅਸ ਉਹ ਸਾਡੇ ਨਾਲੋਂ ਕਾਫ਼ੀ ਅੱਗੇ ਤਾਂ ਕਿਉਂਕਿ ਭਾਅ ਜੀ ਸਾਡੇ ਨਾਲੋਂ ਹਾਈ ਟਕਨੋਲਜੀ 'ਚ ਰਹੇ ਵੇ ਤੇ ਅਗਲੇ ਠੀਕ ਨਹੀਂ ਹੈਗਾ ਜੀ ਜਦ ਜਦ ਇੱਥੇ ਜਦ ਇੱਥੇ ਦੇ ਲੋਕਾਂ ਨੇ ਉਹ ਦੇੇਖਿਆ ਕਿ ਜਿਹੜੇ ਉੱਥੇ ਦੇ ਜਿਹੜੇ ਬਾਹਰ ਗਏ ਵੇ ਲੋਕ ਹੈਗੇ ਹੈ ਵੀ ਉਹ ਉਹਨਾਂ ਦਾ ਰਹਿਣ ਸਹਿਣ ਉਹਨਾਂ ਦਾ ਆਚਰਣ ਉਹਨਾਂ ਦੀ ਆਮਦਨ ਆਰਥਿਕਤਾ ਪੱਧਰ 'ਤੇ ਉਹ ਸਾਡੇ ਨਾਲੋਂ ਤਾਂ ਕਾਫ਼ੀ ਉੱਚਾ ਸੀਗਾ ਹਾਂਜੀ ਹਾਂਜੀ ਭਾਅ ਜੀ ਇਹਦੇ ਕਰਕੇ ਜ ਅਗਲਿਆਂ ਨੇ ਇਹ ਸਭ ਫ਼ਰਕ ਦੇੇਖੇ ਹੈਗੇ ਹੈ ਆਪਣੇ ਇੱਥੇ ਫਿਰ ਇਹਦੇ ਕਰਕੇ ਭਾਅ ਜੀ ਇਨ੍ਹਾਂ ਜਿਹੜਾ ਇੱਥੇ ਜਿਹੜਾ ਨਵਾਂਸ਼ਹਿਰ ਦਾ ਇੱਥੇ ਦੇ ਜਿਹੜੇ ਮਤਲਬ ਜਿਹੜੇ ਨੌਜਵਾਨ ਤੇ ਭਾਵੇਂ ਬੁੱਢੇ ਤੇ ਜਿਹੜੇ ਵੀ ਹੈਗੇ ਤੇ ਉਹਨਾਂ ਨੇ ਬਾਹਰ ਦਾ ਟ੍ਰੈਂਡ ਬਣਾ ਲਿਆ ਤੁਸੀਂ ਤਾਂ ਇੱਕ ਭਾਅ ਜੀ ਸੁਣਿਆ ਹੀ ਹੋਣਾ ਹੈ ਵੀ ਕਹਿੰਦੇ ਨਹੀਂ ਹੈਗੇ ਹੈ ਇੱਕ ਇੱਕ ਹਾਂਜੀ ਹਾਂਜੀ ਜਿੱਦਾਂ ਉਹ ਕਹਿੰਦੇ ਨਹੀਂ ਹੈਗੇ ਹੈ ਭਾਅ ਜੀ ਵੀ ਜਿੱਦਾਂ ਕਹਿੰਦੇ ਪੂਰੇ ਪੰਜਾਬ 'ਚ ਰੁਪਇਆ ਚੱਲਦਾ ਨਵਾਂਸ਼ਹਿਰ 'ਚ ਡਾਲਰ ਚੱਲਦਾ ਹਾਂਜੀ ਹਾਂਜੀ ਭਾਅ ਜੀ ਉਹ ਤਾਂ ਹੀ ਚੱਲਦਾ ਹੈਗਾ ਭਾਅ ਜੀ ਤਾਂ ਹੀ ਕਹਿੰਦੇ ਕਿਉਂਕਿ ਇੱਥੇ ਦੇ ਲੋਕ ਸਾਰੇ ਬਾਹਰ ਗਏ ਵੇ ਸਾਡਾ ਤਾਂ ਜਿਹੜਾ ਜਿਹੜਾ ਹੈਗਾ ਨਵਾਂਸ਼ਹਿਰ ਜ਼ਿਲ੍ਹਾ ਇਹ ਐਨੱ ਆਰ ਆਈਆਂ ਦਾ ਵੱਜਦਾ ਹੈਗਾ ਹੈ ਇੱਥੇ ਤੋਂ ਅੱਛਾ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਐਨੀ ਟਾਈਮ ਜੀ ਕੋਈ ਗੱਲ ਨਹੀਂ ਭਾਅ ਜੀ ਕੋਈ ਗੱਲ ਨਹੀਂ ਜੀ ਐਨੀ ਟਾਈਮ ਜੀ ਕੋਈ ਗੱਲ ਨਹੀਂ ਭਾਅ ਜੀ ਕੋਈ ਗੱਲ ਨਹੀਂ ਜੀ ਵੈਲਕੱਮ ਜੀ ਓਕੇ ਜੀ ਓਕੇ